ਮੈਂ ਇੱਕ ਦਿਨ ਸਰਹਿੰਦ ਤੋਂ ਚੰਡੀਗੜ੍ਹ ਜਾਣਾ ਸੀ ਪਰ ਮੈਂ ਦੇਖਿਆ ਕਿ ਕਈ ਮੇਰੀ ਗੱਡੀ ਵਿੱਚ ਟੈਕਨੀਕਲ ਫਲਟ ਆ ਗਿਆ ਸਟਾਰਟ ਨਹੀਂ ਸੀ ਹੋ ਰਹੀ ਫਿਰ ਮੈਂ ਤੁਰੰਤ ਇੱਕ ਕੈਬ ਬੁੱਕ ਕੀਤੀ ਅਤੇ ਪਰ ਮੈਂ ਕਾਫੀ ਦੇਰ ਦੇਖਿਆ ਵੀ ਕੈਬ ਦਾ ਮੈਂ ਵੇਟ ਕਰਦਾ ਰਿਹਾ ਅਤੇ ਕੈਬ ਡਰਾਈਵਰ ਮੈਨੂੰ ਬਾਰ ਬਾਰ ਇਹੀ ਕਹਿ ਰਿਹਾ ਸੀ ਮੈਂ ਬਹੁਤ ਜਲਦੀ ਪੁੱਜ ਰਿਹਾਂ ਪਰ ਉਹ ਮੈਨੂੰ ਲੇਟ ਕਰ ਰਿਹਾ ਸੀ ਜਿਸ ਕਾਰਨ ਮੈਨੂੰ ਟੈਂਸ਼ਨ ਹੋ ਰਹੀ ਸੀ ਮੈਂ ਉੱਥੇ ਸਮੇਂ ਸਿਰ ਪੁੱਜਣਾ ਸੀ ਫਿਰ ਮੈਂ ਕੁਛ ਸਮੇਂ ਬਾਅਦ ਆਪਣੇ ਇੱਕ ਦੋਸਤ ਨਾਲ ਸੰਪਰਕ ਕੀਤਾ ਉਹਨੇ ਮੈਨੂੰ ਦੱਸਿਆ ਕਿ ਮੈਂ ਵੀ ਚੰਡੀਗੜ੍ਹ ਹੀ ਜਾ ਰਿਹਾਂ ਅਤੇ ਉਹ ਮੈਨੂੰ ਮੇਰੇ ਨਿਸ਼ਚਿਤ ਸਥਾਨ 'ਤੇ ਸਮੇਂ ਸਿਰ ਛੱਡ ਦੇਵੇਗਾ ਅਤੇ ਇਸ ਤਰ੍ਹਾਂ ਮੈਨੂੰ ਜਿਹੜੀ ਮੇਰੀ ਟੈਨਸ਼ਨ ਸੀ ਉਹ ਖੁਸ਼ੀ ਵਿੱਚ ਬਦਲ ਗਈ ਅਤੇ ਮੇਰਾ ਮਿੱਤਰ ਮੈਨੂੰ ਸਮੇਂ ਸਿਰ ਚੰਡੀਗੜ੍ਹ ਲੈ ਕੇ ਗਿਆ ਅਤੇ ਮੈਂ ਜਿੱਥੇ ਪੁੱਜਣਾ ਸੀ ਜ਼ਰੂਰੀ ਮੀਟਿੰਗ ਵਿੱਚ ਸਮੇਂ ਸਿਰ ਪਹੁੰਚ ਗਿਆ ਇਸ ਤਰ੍ਹਾਂ ਮੈਂ ਕੈਬ ਡਰਾਈਵਰ ਨੂੰ ਫਿਰ ਫੋਨ ਕੀਤਾ ਕਿ ਉਹਨੇ ਜੋ ਮੇਰੇ ਨਾਲ ਐਗਰੀਮੈਂਟ ਕੀਤਾ ਸੀ ਉਹਨੂੰ ਸਮੇਂ ਸਿਰ ਪੁੱਜਣਾ ਚਾਹੀਦਾ ਸੀ ਇਸ ਤਰ੍ਹਾਂ ਮੈਂ ਕੈਬ ਉਹ ਰੱਦ ਕਰ ਦਿੱਤੀ ਅਤੇ ਅੱਗੇ ਨੂੰ ਉਹਨੂੰ ਮੈਂ ਸੁਜੈਸਟ ਵੀ ਕੀਤਾ ਕਿ ਜੋ ਟਾਈਮ ਦਿੱਤਾ ਹੈ ਸਮੇਂ ਸਿਰ ਪੁੱਜਣਾ ਚਾਹੀਦਾ ਹੈ ਅਤੇ ਉਹਨੇ ਵੀ ਮੇਰੇ ਤੋਂ ਸੋਰੀ ਮੰਗੀ ਧੰਨਵਾਦ